ਭੰਗੜੇ ਨੂੰ ਅਸੀਂ ਕਈ ਗਰੁੱਪਾਂ ਵਿੱਚ ਪਰਫੋਰਮ ਕਰਦੇ ਹਾਂ ਪੇਸ਼ ਕਰਦੇ ਹਾਂ ਭੰਗੜੇ ਵਿੱਚ ਅਸੀਂ ਕਾਫੀ ਸਾਰੇ ਕੁੜੀਆਂ ਮੁੰਡੇ ਇਕੱਠੇ ਹੋ ਕੇ ਇੱਕ ਬੀਟ ਅਤੇ ਇਕ ਢੋਲ ਦੀ ਆਵਾਜ਼ 'ਤੇ ਪੇਸ਼ ਕਰਦੇ ਹਾਂ ਭੰਗੜੇ ਦੀ ਪ੍ਰੈਕਟਿਸ ਕਰਨ ਦੇ ਸਮੇਂ ਸਾਰੇ ਇਕੱਠੇ ਹੁੰਦੇ ਹਨ ਜਿਸ ਵਿੱਚ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਜਿਸ ਦੇ ਨਾਲ ਕੋਆਰਡੀਨੇਸ਼ਨ ਵੀ ਬਹੁਤ ਵਧੀਆ ਹੁੰਦਾ ਹੈ ਭੰਗੜਾ ਇੱਕ ਸਮੂਹਿਕ ਨਾਚ ਹੈ ਜਿਸ ਵਿੱਚ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹਨ ਅਤੇ ਸਟੈਪ ਸੋਚਦੇ ਹਨ ਅਤੇ ਅਲੱਗ ਅਲੱਗ ਤਰ੍ਹਾਂ ਦੇ ਭੰਗੜੇ ਨੂੰ ਪਰ ਪੇਸ਼ ਕਰਦੇ ਹਾਂ ਭੰਗੜੇ ਦੇ ਨਾਲ ਸਾਨੂੰ ਇੱਕ ਦਿਮਾਗ ਦੀ ਸ਼ੇਅਰਿੰਗ ਕਰਨ ਦੀ ਬਹੁਤ ਸ਼ਕਤੀ ਮਿਲਦੀ ਹੈ ਭੰਗੜੇ ਨਾਲ ਅਸੀਂ ਇੱਕ ਦੂਜੇ ਨੂੰ ਜਾਣ ਕੇ ਉਹਨਾਂ ਨੂੰ ਆਪਣਾ ਦੋਸਤ ਬਣਾ ਸਕਦੇ ਹਾਂ ਅਤੇ ਦੂਜੇ ਰਿਲੇਸ਼ਨ ਵੀ ਬਣਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਭੰਗੜੇ ਨਾਲ ਅਸੀਂ ਇੱਕ ਦੂਜੇ ਨੂੰ